ਲਾਲਾ ਲਾਜਪਤ ਰਾਏ ਭਾਰਤੀ ਸੁਤੰਤਰਤਾ ਅੰਦੋਲਨ ਦੇ ਮਹੱਤਵਪੂਰਨ ਨੇਤਾ ਸਨ ਉਹਨਾਂ ਨੂੰ ਸ਼ੇਰ ਏ ਪੰਜਾਬ ਵੀ ਕਿਹਾ ਜਾਂਦਾ ਹੈ ਅਤੇ ਦੇਸ਼ ਭਗਤੀ ਅਤੇ ਨਿਡਰਤਾ ਕਾਰਨ ਉਹ ਬਹੁਤ ਜ਼ਿਆਦਾ ਦੇਸ਼ ਵਿੱਚ ਪ੍ਰਚਲਿਤ ਹੋਏ ਅਤੇ ਉਹਨਾਂ ਨੇ ਬਹੁਤ ਸਾਰੀ ਭੂਮਿਕਾ ਨਿਭਾਈ ਉਹਨਾਂ ਦੀ ਲੀਡਰਸ਼ਿਪ ਅਤੇ ਸਮਰਪਣ ਨੇ ਪ ਪੰਜਾਬ ਵਿੱਚ ਰਾਸ਼ਟਰੀ ਜਾਗਰਰੂਕਤਾ ਨੂੰ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਬਹੁਤ ਸਾਰਾ ਸੰਘਰਸ਼ ਅਤੇ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਲੀਡਰਸ਼ਿਪ ਬਹੁਤ ਪ੍ਰਮੁੱਖ ਨੇਤਾ ਸਨ ਅਤੇ ਉਹਨਾਂ ਨੇ ਇਸ ਦੀਆਂ ਨੀਤੀਆਂ ਦੇ ਘਾਟ ਅਤੇ ਉਹਨਾਂ ਦੇ ਸਟਰਕਚਰ ਵਿੱਚ ਬਹੁਤ ਸਾਰਾ ਯੋਗਦਾਨ ਪਾਇਆ ਉਹਨਾਂ ਨੂੰ ਬਾਲ ਪਾਲ ਕਿਹਾ ਜਾਂਦਾ ਹੈ ਅਤੇ ਉਹ ਕਾਂਗਰਸ ਦੇ ਉਤਾਰਵਾਦੀ ਦ੍ਰਿਸ਼ਟੀਕੋਣ ਦੀ ਥਾਂ ਉਗਰਵਾਦੀ ਦ੍ਰਿਸ਼ਟੀਕੋਣ ਪ੍ਰਤੀਨਿਧ ਕਰਦੇ ਹਨ ਉਹਨਾਂ ਨੇ ਸਵਰਾਜ ਦੀ ਮੰਗ ਕੀਤੀ ਅਤੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਬਹੁਤ ਸਾਰੇ ਸ਼ ਬਹੁਤ ਸਾਰੇ ਸੰਘਰਸ਼ ਉਠਾਏ ਜਿਸ ਨਾਲ ਕਾਂਗਰਸ ਵਿੱਚ ਨਵੀਂ ਜਾਗਰਿਤ ਆਈ ਪੰਜਾਬ ਵਿੱਚ ਯਤਨ ਅਤੇ ਸੰਘਰਸ਼ ਲਾਲਾ ਲਾਜਪਤ ਰਾਏ ਨੇ ਲੋਕਾਂ ਨੂੰ ਰਾਸ਼ਟਰੀ ਚੇਤਨਤਾ ਵੱਲ ਪ੍ਰੇਰਿਤ ਕੀਤਾ